ਮੇਰੇ ਲਈ ਮਾ ਮੇਰੇ ਲਈ ਮੇਰੇ ਸਭ ਤੋਂ ਵੱਧ ਯਾਦਗਾਰੀ ਯਾਤਰਾ ਆਨੰਦਪੁਰ ਦੀ ਯਾਤਰਾ ਸੀ ਕਿਉਂਕਿ ਪਿਛਲੇ ਹੀ ਸਾਲ ਮੈਂ ਨਾਨਕੇ ਗਿਆ ਹੋਇਆ ਸੀ ਅਤੇ ਉੱਥੇ ਨਾਨਕੇ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਬੈਠੇ ਹਾਂ ਅਸੀਂ ਅਤੇ ਮਾਮੂ ਜਿਹੜੇ ਮੇਰੇ ਛੋਟੇ ਮਾਮੂ ਦੋ ਮਾਮੂ ਫਿਰ ਛੋਟੇ ਮਾਮੂ ਜਿਹੜੇ ਬਾਹਰੋਂ ਡਬਈ ਤੋਂ ਆਏ ਹੋਏ ਤਾਂ ਅਚਾਨਕ ਹੀ ਸਾਡਾ ਉਹਨਾਂ ਦਾ ਮਨ ਵੈ ਬਣ ਗਿਆ ਕਿ ਅਸੀਂ ਆਨੰਦਪੁਰ ਨੂੰ ਸਾਰੀ ਫੈਮਲੀ ਕਿਉਂ ਨਾ ਹੋ ਆਈਏ ਕਿਉਂ ਪੀ ਨਾਨੂ ਜੀ ਥੋੜ੍ਹੇ ਜਿਹੇ ਬਿਮਾਰ ਰਹਿੰਦੇ ਅਤੇ ਉਹਨਾਂ ਨੇ ਸੁੱਖਨਾ ਸੁੱਖੀ ਸੀ ਵੀ ਚਲੋ ਜਦੋਂ ਵੀ ਨਿੱਕੇ ਮਾਮੂ ਆ ਜਾਣਗੇ ਥੋੜ੍ਹੇ ਬਹੁਤੇ ਚੱਲ ਪੈਰ ਲੈਣਗੇ ਨਾਨੂ ਤਾਂ ਅਸੀਂ ਆਨੰਦਪੁਰ ਚਲਾਂਗੇ ਇਸ ਕਰਕੇ ਉਹਨਾਂ ਦਾ ਅਚਾਨਕ ਉੱਥੇ ਟੂਰ ਜਿਹਾ ਆਨੰਦਪੁਰ ਜਾਣ ਦਾ ਟੂਰ ਬਣ ਗਿਆ ਅਤੇ ਉਹਨਾਂ ਨੇ ਗੱਡੀ ਬੁੱਕ ਕਰਵਾ ਲਈ ਇਨੋਵਾ ਅਤੇ ਉਹਨਾਂ ਵਿੱਚ ਅਸੀਂ ਸਾਰੀ ਫੈਮਿਲੀ ਬਹਿ ਕੇ ਆਨੰਦਪੁਰ ਦੀ ਯਾਤਰਾ ਲਈ ਚਲੇ ਗਏ ਅਤੇ ਮੈਂ ਤਾਂ ਪਹਿਲੋਂ ਹੀ ਉੱਥੇ ਨਾਨਕੇ ਗਿਆ ਆਇਆ ਹੋਇਆ ਪੀ ਮਾਮੂ ਆਏ ਆ ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਮਿਲ ਲਵਾ ਜਿਹਾਤੇ ਇਸ ਕਰਕੇ ਮੇਰੀ ਉਹ ਯਾਦਗਾਰੀ ਕਿਉਂਕਿ ਯਾਦ ਯਾਦਗਾਰੀ ਯਾਤਰਾ ਇਸ ਕਰਕੇ ਯਾਰੀ ਬਣ ਮਨਪਸੰਦ ਬਣੀ ਕਿਉਂ ਪੀ ਮੈਂ ਇੱਕ ਤਾਂ ਪੂਰੀ ਆਪਣੀ ਫੈਮਿਲੀ ਨਾਨਕੇ ਨਾਲ ਹੀ ਤਾਂ ਕਰਕੇ ਅਤੇ ਉਧਰੋਂ ਬਾਅਦ 'ਚ ਮਾਮਾ ਮਾਮੀ ਪਾਪਾ ਪਾਪਾ ਵੀ ਆ ਗਏ ਪਾਪਾ ਮੰਮਾ ਵੀ ਗਏ ਅਤੇ ਉਹਨਾਂ ਨਾਲ ਆਪਾਂ ਸਾਰੀ ਫੈਮਲੀ ਪੂਰੀ ਜਿਹੜੀ ਇਕੱਠੀ ਉੱਥੇ ਯਾਤਰਾ ਬਣ ਗਈ ਅਤੇ ਨਾਲ ਇੱਕ ਉਹ ਹਰਿਮੰਦਰ ਸਾਹਿਬ ਵੀ ਉਦੋਂ ਉੱਥੇ ਉਸ ਤੋਂ ਬਾਅਦ ਆਉਂਦੀ ਬਾਕੀ ਆਪਾਂ ਹਰਿਮੰਦਰ ਸਾਹਿਬ ਵੀ ਮੱਥਾ ਟੇਕਿਆ ਪੀ ਉੱਥੇ ਮੇਲਾ ਲੱਗਾ ਹੋਇਆ ਸੀ ਬਾਕੀ ਇਹ ਮੇਰੀ ਯਾਦਗਾਰੀ ਸਭ ਤੋਂ ਯਾਤਰਾ ਰਹੀ